ਜਦੋਂ ਮੈਂ ਇੱਕ ਲੰਬੀ ਬਾਈਕਿੰਗ ਯਾਤਰਾ ਜਾਂ ਟੂਰ ਦੀ ਯੋਜਨਾ ਬਣਾਉਂਦਾ ਹਾਂ ਅਤੇ ਮੈਂ ਹਮੇਸ਼ਾਂ ਕੁਝ ਜ਼ਰੂਰੀ ਚੀਜ਼ਾਂ ਨੂੰ ਪੈਕ ਜ਼ਰੂਰ ਕਰਦਾ ਹਾਂ ਇੱਥੇ ਕੁਝ ਚੀਜ਼ਾਂ ਹਨ ਜੋ ਮੈਂ ਇੱਥੇ ਨਾਲ ਲੈ ਕੇ ਜਾਂਦਾ ਹਾਂ ਸੂਰਜ ਹਵਾ ਅਤੇ ਸੰਭਾਵਿਕ ਹਾਦਸਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਇੱਕ ਹੈਲਮਟ ਦਸਤਾਨੇ ਅਤੇ ਸੰਨਗਲਾਸ ਇੱਕ ਸਾਈਕਲ ਮੁਰੰਮਤ ਕਿੱਟ ਜਿਸ ਵਿੱਚ ਇੱਕ ਪੰਪ ਟਿਊਬ ਇੱਕ ਪੈਚ ਕਿਟ ਅਤੇ ਇੱਕ ਮਲਟੀ ਟੂਲ ਕਿਟ ਜਿਵੇਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ਹਾਈਡਰੇਟਿਡ ਅਤੇ ਊਰਜਾਵਾਨ ਰਹਿਣ ਲਈ ਪਾਣੀ ਅਤੇ ਕੁਝ ਸਨੈਕਸ ਮੇਰੇ ਰੂਟ ਨੂੰ ਨੈਵੀਗੇਟ ਕਰਨ ਲਈ ਅਤੇ ਦਿਲਚਸਪ ਥਾਂ ਨੱਥਣ ਲਈ ਇੱਕ ਨਸ਼ਕਾ ਨਕਸ਼ਾ ਜਾਂ ਇੱਕ ਜੀ ਪੀ ਐੱਸ ਡਿਵਾਈਸ ਜ਼ਰੂਰ ਮੇਰੇ ਨਾਲ ਹੁੰਦਾ ਹੈ ਸੁੰਦਰ ਨਜ਼ਾਰੇ ਅਤੇ ਯਾਦਗਾਰੀ ਪਲਾਂ ਨੂੰ ਕੈਪਚਰ ਕਰਨ ਲਈ ਇੱਕ ਕੈਮਰਾ ਜਾਂ ਇੱਕ ਫੋਨ ਮੈਂ ਆਪਣੇ ਡਿਵਾਈਸਾਂ ਨੂੰ ਚਾਲੂ ਰੱਖਣ ਲਈ ਪਾਵਰ ਬੈਂਕ ਅਤੇ ਚਾਰਜਰ ਵੀ ਨਾਲ ਹੀ ਰੱਖਦਾ ਹਾਂ ਮੇਰੇ ਸਾਰੇ ਚੀਜ਼ਾਂ ਨੂੰ ਸਟੋਰ ਕਰਨ ਲਈ ਇੱਕ ਛੋਟਾ ਬੈਗ ਮੈਂ ਆਪਣੀ ਰੋਸ਼ਨੀ ਨੂੰ ਪੈਕ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸਿਰਫ ਉਹੀ ਹੀ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ ਜੋ ਕਿ ਅਸਲ ਵਿੱਚ ਚਾਹੀਦਾ ਹੈ ਇਹ ਕੁਝ ਚੀਜ਼ਾਂ ਹਨ ਜੋ ਮੇਰੇ ਲੰਬੇ ਬਾਈਕਿੰਗ ਯਾਤਰਾਵਾਂ ਜਾਂ ਟੂਰ ਦਾ ਆਨੰਦ ਲੈਣ ਵਿੱਚ ਮੇਰੀ ਮਦਦ ਕਰਦੀਆਂ ਹਨ ਧੰਨਵਾਦ